ਮੈਂ ਅੱਜ ਤੋਂ ਦੋ ਦਿਨ ਪਹਿਲਾਂ ਦੁਪਹਿਰ ਦਾ ਖਾਣਾ ਮੰਗਵਾਇਆ ਸੀ ਜੋ ਕਿ ਮੈਂ ਆਪਣੇ ਫ਼ੋਨ ਤੋਂ ਸਵਿਗੀ ਐਪਲੀਕੇਸ਼ਨ ਦੁਆਰਾ ਆਰਡਰ ਕੀਤਾ ਸੀ ਉਸਦੀ ਰਸੀਦ ਮੇਰੇ ਕੋਲ ਨਹੀਂ ਪੁੱਜੀ ਪਰ ਮੈਨੂੰ ਉਹ ਰਸੀਦ ਬਹੁਤ ਜਰੂਰੀ ਚਾਹੀਦੀ ਹੈ ਇਸ ਕਰਕੇ ਮੈਂ ਸਵਿਗੀ ਐਪਲੀਕੇਸ਼ਨ ਦੇ ਆਰਡਰ ਇਤਿਹਾਸ ਵਿੱਚ ਜਾ ਕੇ ਉਹ ਰਸੀਦ ਡਾਊਨਲੋਡ ਕਰ ਲਈ ਹੈ